ਮੋਟਰਸਾਈਕਲ ਇੱਕ ਅਜਿਹਾ ਹੈ ਜੋ ਹਰੇਕ ਘਰ ਦੇ ਵਿੱਚ ਹੈ ਅਤੇ ਹਰੇਕ ਆਦਮੀ ਇਸ ਦੀ ਵਰਤੋਂ ਕਰਦਾ ਹੈ ਇਸਦੀ ਜੋ ਮਕੈਨੀਕਲ ਕੰਮ ਹਨ ਚਾਹੇ ਉਹ ਥੋੜ੍ਹੀ ਦੂਰ ਆ ਚਾਹੇ ਲੰਬੇ ਸਫ਼ਰ ਹੈ ਜਿਸ ਦੇ ਵਿੱਚ ਟਾਇਰ ਦੇ ਵਿੱਚ ਹਵਾ ਭਰਨੀ ਜਾਂ ਜਿੱਦਾਂ ਹੁਣ ਟਿਊਬਲੈਸ ਟਾਇਰ ਆਉਂਦੇ ਹਨ ਉਹਨਾਂ ਦਾ ਪੈਂਚਰ ਲਗਾਉਣਾ ਆਉਣਾ ਚਾਹੀਦਾ ਹੈ ਮਕੈਨੀਕਲ ਕੰਮ ਜਿਵੇਂ ਕਾਰਪੇਟਰ ਸਾਫ਼ ਕਰਨਾ ਇਸ ਤੋਂ ਇਲਾਵਾ ਕੋਈ ਗੜਬੜੀ ਹੁੰਦੀ ਹੈ ਤੋ ਉਸ ਦਾ ਜੋ ਮੇਨ ਕੰਮ ਹੈ ਜਿੱਦਾਂ ਵੀ ਸਪਾਰਕਰ ਪਲੱਗ ਹੁੰਦਾ ਉਹ ਤੁਹਾਨੂੰ ਚੈੱਕ ਕਰਕੇ ਸਾਫ਼ ਕਰਕੇ ਦੁਬਾਰਾ ਲਗਾਉਣਾ ਚਾਹੀਦਾ ਹੈ ਗੜਬੜੀ ਕੋਈ ਛੋਟੀ ਮੋਟੀ ਗੜਬੜੀ ਜਿੱਦਾਂ ਕੋਈ ਰੀਅਸ ਤਾਰ ਦੀ ਤਾਰ ਪਾਉਣੀ ਆਉਣੀ ਚਾਹੀਦੀ ਹੈ ਅਤੇ ਇਦਾਂ ਛੋਟੇ ਮੋਟੇ ਕੰਮ ਤੁਹਾਨੂੰ ਆਉਣੇ ਚਾਹੀਦੇ ਹਨ ਤਾਂ ਜੋ ਲੰਬੇ ਸਫ਼ਰ ਦੇ ਵਿੱਚ ਕੋਈ ਗੜਬੜੀ ਨਾ ਹੋ ਸਕੇ ਅਤੇ ਤੁਸੀਂ ਇਸਨੂੰ ਦਰੁਸਤ ਕਰ ਸਕਦੇ ਓਂ ਠੀਕ ਕਰ ਸਕਦੇ ਹੋ ਮੋਟਰਸਾਈਕਲ ਨੂੰ ਤਾਂ ਜੋ ਮਾੜੇ ਮੋਟੇ ਕੰਮ ਤੁਸੀਂ ਆਪ ਕਰ ਸਕਦੇ ਤਾਂ ਜੋ ਤੁਹਾਡਾ ਪੈਸਾ ਵੀ ਬਚ ਸਕਦਾ ਹੈ